ਸਾਡੇ ਖੇਤਰ ਵਿੱਚ ਇੱਕ ਡਿਸਪੈਂਸ਼ਰੀ ਖੋਲ੍ਹੀ ਗਈ ਹੈ ਜਿੱਥੇ ਰੋਜ਼ਾਨਾ ਯੋਗਾ ਕਰਵਾਈ ਜਾਂਦੀ ਹੈ ਅਤੇ ਮੈਂ ਵੀ ਉੱਥੇ ਜਾ ਕੇ ਯੋਗਾ ਕਰਦੀ ਹਾਂ ਜਿਸ ਨਾਲ਼ ਮੇਰੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਸਾਡੇ ਆਲ਼ੇ ਦੁਆਲ਼ੇ ਬਿਮਾਰੀ ਨਹੀਂ ਹੁੰਦੀ ਅਤੇ ਮੇਰੀ ਇੱਛਾ ਹੈ ਕਿ ਮੈਂ ਪੰਜਾਬ ਪੁਲਿਸ ਵਿੱਚ ਜਾਵਾਂ ਅਤੇ ਪੰਜਾਬ ਪੁਲਿਸ ਵਿੱਚ ਜਾਣ ਲਈ ਮੈਂ ਰੋਜ਼ਾਨਾ ਦੌੜਦੀ ਹਾਂ ਅਤੇ ਉਸ ਦੌੜਨ ਨਾਲ਼ ਮੇਰੀ ਜੋ ਸਪੀਡ ਹੈ ਉਹ ਵੱਧਦੀ ਹੈ